ਜੇ ਕੰਮ ਵਾਲੀ ਥਾਂ 'ਤੇ ਮੇਰੇ ਨਾਲ਼ ਕੋਈ ਗੱਲ ਜਾਂ ਵਿਵਾਦ ਹੁੰਦਾ ਹੈ ਤਾਂ ਮੈਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਪੂਰਾ ਮੈਂ ਉਸ ਗੱਲ 'ਤੇ ਗੁੱਸਾ ਕਰਨ ਜਾਂ ਵਧਾਉਣ ਦੀ ਬਜਾਏ ਉਸਨੂੰ ਖ਼ਤਮ ਕਰਨ ਬਾਰੇ ਸੋਚੂੰਗਾ ਮੈਂ ਚੰਗੀ ਤਰ੍ਹਾਂ ਪਿਆਰ ਨਾਲ਼ ਅਗਲੇ ਬੰਦੇ ਨਾਲ਼ ਹੱਲ ਕਰਨ ਦੀ ਟਰਾਈ ਕਰੂੰਗਾ ਆਪਣੇ ਪੁਆਇੰਟ ਔਫ਼ ਵਿਊ ਅੱਗੇ ਰੱਖੂੰਗਾ ਅਤੇ ਅਗਲੇ ਬੰਦੇ ਦੀ ਵੀ ਸੁਣਾਂਗਾ ਅਤੇ ਜੇ ਮੈਂ ਉਸ ਚੀਜ਼ 'ਚ ਗਲਤ ਹੋਵਾਂਗਾ ਤਾਂ ਮੈਂ ਆਪਣੀ ਗਲਤੀ ਮੰਨਾਂਗਾ ਅਤੇ ਜੇ ਅਗਲਾ ਬੰਦਾ ਗਲ਼ਤ ਹੋਵੇ ਤਾਂ ਉਹਨੂੰ ਸਮਝਾਉਣ ਦੀ ਟਰਾਈ ਕਰੂੰਗਾ ਕਿ ਤੇਰੀ ਗਲ਼ਤੀ ਆ ਅਤੇ ਆਪਾਂ ਸਲਾਹ ਕਰਕੇ ਖ਼ਤਮ ਕਰ ਸਕਦੇ ਹਾਂ ਇਸਨੂੰ ਮੈਂ ਪੂਰਾ ਟਰਾਈ ਕਰੂੰਗਾ ਕਿ ਗੱਲ ਅੱਗੇ ਹੱਥੋਂ ਪਾਈ ਜਾਂ ਅੱਗੇ ਨਾ ਪੁੱਜੇ ਨਹੀਂ ਤਾਂ ਉਸ ਕਰਕੇ ਮੈਨੂੰ ਆਪਣਾ ਕੰਮ ਤੋਂ ਵੀ ਕੱਢਿਆ ਜਾ ਸਕਦਾ ਹੈ ਮੈਂ ਆਪਣਾ ਇੰਨਕਮ ਸੋਰਸ ਵੀ ਗਵਾ ਸਕਦਾ ਅਤੇ ਸਾਹਮਣੇ ਵਾਲੇ ਦੇ ਜਾਂ ਦੀ ਦੁਸ਼ਮਣੀ 'ਚ ਵੀ ਆ ਸਕਦਾ ਵਾ ਇਸ ਲਈ ਮੈਂ ਸਮਝੌਤਾ ਕਰਨ ਬਾਰੇ ਸੋਚਾਂਗਾ